ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀਓ ਇੰਟਰਨੈਟ ਸੇਵਾ ਤੋਂ ਬੋਲ ਰਹੇ ਹੋ ਹਾਂਜੀ ਮੈਮ ਹਾਂਜੀ ਅਸੀਂ ਤਾਂ ਤੁਹਾਨੂੰ ਕੰਪਲੇਂਟ ਹੀ ਕਰਨੀ ਸੀਗੀ ਜੀ ਵੀ ਸਾਡੇ ਨਾ ਮਤਲਬ ਜਿਹੜਾ ਡਾਟਾ ਨੈਟ ਹੈਗਾ ਬਹੁਤ ਸਲੋ ਚੱਲਦਾ ਮੈਡਮ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਮੈਡਮ ਦੇਖੋ ਅਸੀਂ ਸਾਰੇ ਕੰਮ ਹੀ ਇੰਟਰਨੈਟ 'ਤੇ ਕਰਨੇ ਨੇਗੇ ਹੁਣ ਅਸੀਂ ਤੁਹਾਨੂੰ ਸਿਰਫ ਸਿਰਫ ਇਹ ਗੱਲ ਕਹਿਣੀ ਹੈਗੀ ਵੀ ਸਾਨੂੰ ਇਹ ਦੱਸੋ ਵੀ ਇਹ ਹੋ ਕਿਉਂ ਰਿਹਾ ਹੈਗਾ ਹਾਂਜੀ ਮੈਡਮ ਉਹ ਜੀ ਦੱਸੋ ਵੀ ਸਾਨੂੰ ਸਾਡਾ ਡਾਟਾ ਕਿਤੇ ਕੋਈ ਲੀਕ ਤਾਂ ਨਹੀਂ ਹੋ ਰਿਹਾ ਜਾਂ ਸਾਡੇ ਡਾਟੇ ਦੀ ਕੋਈ ਹੋਰ ਵਰਤੋਂ ਤਾਂ ਨਹੀਂ ਹੋ ਰਹੀ ਕਿਤੇ ਇੰਨਾ ਸਲੋ ਕਿਉਂ ਚੱਲ ਰਿਹਾ ਮੈਡਮ ਅਸੀਂ ਆਨਲਾਈਨ ਕਲਾਸਾਂ ਵੀ ਲਗਾਉਣੀਆਂ ਨੇ ਅਸੀਂ ਮੈਡਮ ਆਨਲਾਈਨ ਆਪਣੇ ਹੋਰ ਵੀ ਬਿੱਲ ਪੇਅ ਕਰਨੇ ਨੇ ਬਹੁਤ ਕੰਮ ਕਰਨੇ ਨੇ ਸਾਰੇ ਕੰਮ ਹੀ ਆਨਲਾਈਨ ਨੇ ਵੀ ਜੇ ਸਾਡੇ ਇੰਟਰਨੈਟ ਦੀ ਸਪੀਡ ਬਹੁਤ ਘੱਟ ਰਹੂਗੀ ਮੈਡਮ ਹਾਂਜੀ ਫਿਰ ਇਹ ਕੰਮ ਕਿਵੇਂ ਹੋਣਗੇ ਹਾਂ ਜੀ ਮੈਡਮ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਜੀ ਵੀ ਸਾਡਾ ਇਸ ਮੋਬਾਈਲ ਜਿਹੜੀਆਂ ਡਾਟਾ ਗਾ ਇਹ ਸਲੋ ਕਿਉਂ ਚਲਦਾ ਇਹਦੇ ਬਾਰੇ ਤੁਸੀਂ ਜਾਂਚ ਕਰੋ ਸਾਨੂੰ ਬਹੁਤ ਦਿੱਕਤ ਆਈ ਜਾਂਦੀ ਹੈ ਜੀ ਸਾਡੇ ਬੱਚਿਆਂ ਦਾ ਕੰਮ ਸਕੂਲ ਵਾਲੇ ਵੀ ਆਨਲਾਈਨ ਭੇਜਦੇ ਨੇ ਜੀ ਉਹ ਵੀ ਨਹੀਂ ਅਸੀਂ ਦੇਖ ਪਾਉਂਦੇ ਨਾ ਹੀ ਅਸੀਂ ਉਹਨਾਂ ਨੂੰ ਕੰਮ ਕਰਾ ਸਕਦੇ ਹਾਂ ਬਹੁਤ ਕੰਮ ਨੇ ਬੱਚਿਆਂ ਦੇ ਜਿਹੜੇ ਕਰਨੇ ਹੀ ਸਾਨੂੰ ਇੰਟਰਨੈਟ 'ਤੇ ਪੈਂਦੇ ਨੇ ਹਾਂਜੀ ਉਹ ਫਿਰ ਅਸੀਂ ਉਹ ਵੀ ਨਹੀਂ ਕਰਵਾ ਸਕਦੇ ਸਾਨੂੰ ਤਾਂ ਬਹੁਤ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ ਨੇ ਹਾਂਜੀ ਮੈਮ ਤੁਸੀਂ ਹਾਂਜੀ ਸਾਡੀ ਇਸ ਚਿੰਤਾ ਨੂੰ ਦੂਰ ਕਰੋ ਤੁਸੀਂ ਪਲੀਜ਼ ਸਾਡੀ ਰਿਕੁਐਸਟ ਹੈ ਜੀ ਵੀ ਸਾਡਾ ਇਹ ਜਿਹੜਾ ਡਾਟਾ ਲੀਕ ਹੋ ਰਿਹਾ ਜਾਂ ਕੀ ਹੋ ਰਿਹਾ ਇਹਨੂੰ ਤੁਸੀਂ ਜਾਂਚ ਕਰੋ ਹਾਂਜੀ ਸਾਡੀ ਰਿਕੁਐਸਟ ਹੈ ਬਸ ਇਹਦੀ ਜਾਂਚ ਕਰੋ ਅਤੇ ਸਾਨੂੰ ਦੱਸੋ ਜੀ ਵੀ ਇਹ ਕਿਉਂ ਹੋ ਰਿਹਾ ਜੀ ਸਾਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਜੇ ਤੁਸੀਂ ਸਾਡੀ ਇਸ ਚਿੰਤਾ ਦਾ ਹੱਲ ਕਰ ਦਿਉਂਗੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਬਹੁਤ ਧੰਨਵਾਦ ਹੋਵੇਗਾ ਥੈਂਕ ਯੂ